ਵੈਸੇ ਤਾਂ ਇਹ ਦੋਵੇਂ ਹੀ ਚੀਜ਼ਾਂ ਬਹੁਤ ਅੱਛੀਆਂ ਨੇ ਪਰ ਮੈਨੂੰ ਪੰਛੀਆਂ ਨੂੰ ਦੇਖਣ ਲਈ ਦੂਰਬੀਨ ਬਹੁਤ ਪਸੰਦ ਹੈ ਮੈਂ ਜਦੋਂ ਛੋਟੀ ਵੀ ਹੁੰਦੀ ਸੀ ਨਾ ਮੇਰੀ ਮੰਮੀ ਪਾਪਾ ਨੇ ਮੈਨੂੰ ਦੂਰਬੀਨ ਲੈ ਕੇ ਦਿੱਤੀ ਓ ਉਹਦੇ ਵਿੱਚ ਮੈਂ ਦੂਰ ਉੱਪਰ ਆਸਮਾਨ ਵਿੱਚ ਪੰਛੀਆਂ ਨੂੰ ਇੰਨੀ ਨੇੜੇ ਤੇ ਨਾ ਦੇਖਦੀ ਸੀ ਨਾ ਅਤੇ ਮੈਨੂੰ ਬਹੁਤ ਅੱਛਾ ਲੱਗਦਾ ਸੀ ਉਹਦੀ ਇੱਕ ਕਿੰਨੀ ਕੁ ਚੀਜ਼ ਨਜ਼ਰ ਆਉਂਦੀ ਸੀ ਪੰਛੀ ਦੀ ਚੁੰਝ ਉਹਦੇ ਪੰਖ ਉਹਦੀਆਂ ਅੱਖਾਂ ਹੈ ਉਹਦੇ ਪੈਰ ਸਭ ਅਛ ਬਹੁਤ ਅੱਛੀ ਤਰ੍ਹਾਂ ਨਜ਼ਰ ਆਉਂਦਾ ਸੀ ਦੂਰਬੀਨ ਮੈਨੂੰ ਜ਼ਿਆਦਾ ਸਹੀ ਲੱਗੀ ਹੈ